ਜੇਕਰ ਅਸੀਂ ਸੱਭਿਆਚਾਰ ਦੀ ਗੱਲ ਕਰੀਏ ਤਾਂ ਸੱਭਿਆਚਾਰ ਕੀ ਹੁੰਦਾ ਸੱਭਿਆਚਾਰ ਹੁੰਦਾ ਕਿਸੇ ਥਾਂ ਦੇ ਲੋਕਾਂ ਦਾ ਰਹਿਣ ਸਹਿਣ ਕੀ ਹੈ ਉਹਨਾਂ ਦੇ ਕਿੱਤੇ ਕੀ ਨੇ ਉਹਨਾਂ ਦੇ ਰਸਮ ਰਿਵਾਜ਼ ਕੀ ਨੇ ਉਹਨਾਂ ਦੇ ਰਿਸ਼ਤੇ ਨਾਤੇ ਕਿ ਨੇ ਉਹਨਾਂ ਦਾ ਪਹਿਰਾਵਾ ਕਿਵੇਂ ਦਾ ਉਹਨਾਂ ਦੇ ਵਿਸ਼ਵਾਸ ਕਿੱਥੇ ਨੇ ਕਿਹਦੇ ਵਿੱਚ ਉਹ ਵਿਸ਼ਵਾਸ ਕਰਦੇ ਨੇ ਉਹਨਾਂ ਦੀਆਂ ਕਦਰਾਂ ਕੀਮਤਾਂ ਕੀ ਨੇ ਮਨੋਰੰਜਨ ਦੇ ਸਾਧਨ ਕੀ ਨੇ ਅਤੇ ਸਭ ਤੋਂ ਬ ਮਹੱਤਵਪੂਰਨ ਉਹਨਾਂ ਦੀ ਭਾਸ਼ਾ ਕੀ ਹੈ ਅਤੇ ਉਹਨਾਂ ਦੇ ਲੋਕ ਸਾਹਿਤ ਕੀ ਹੈ ਅਤੇ ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਸੱਭਿਆਚਾਰ ਮੰਨਿਆ ਜਾਂਦਾ ਹੈ ਅਤੇ ਇਹਦੇ ਵਿੱਚ ਜਿਹੜੀਆਂ ਸੱਭਿਆਚਾਰਕ ਪਰੰਪਰਾਵਾਂ ਨੇ ਅਸੀਂ ਹੁਣ ਵੀ ਮਨਾਉਂਦੇ ਹਾਂ ਅਤੇ ਉਹਨਾਂ ਨੂੰ ਸਨਮਾਨ ਵੀ ਦਿੰਦੇ ਹਾਂ ਅਤੇ ਪੰਜਾਬੀ ਸੱਭਿਆਚਾਰ ਸੱਭਿਆਚਾਰਕ ਜਿਹੜੀ ਪਰੰਪਰਾਵਾਂ ਨੇ ਉਹਨੂੰ ਮਨਾਉਣ ਅਤੇ ਸਨਮਾਨ ਦੇਣ ਦੇ ਵਿੱਚ ਭਾਸ਼ਾ ਦੀ ਵਰਤੋਂ ਜਿਹੜੀ ਹੈਗੀ ਇੱਕ ਬਹੁਤ ਹੀ ਵੱਡੇ ਲੈਵਲ 'ਤੇ ਕੀਤੀ ਜਾਂਦੀ ਹੈ ਭਾਸ਼ਾ ਦੀ ਵਰਤੋਂ ਨਾਲ਼ ਅਸੀਂ ਉਹਨਾਂ ਪਰੰਪਰਾਵਾਂ ਦੇ ਇਤਿਹਾਸ ਬਾਰੇ ਜਾਣੂ ਹੁੰਦੇ ਹਾਂ ਅਤੇ ਉਹਨਾਂ ਦੇ ਬਾਰੇ ਅਸੀਂ ਆਪਣੀ ਪੀੜ੍ਹੀ ਨੂੰ ਅਗਲੀ ਪੀੜ੍ਹੀ ਨੂੰ ਦੱਸਦੇ ਹਾਂ ਉਹ ਪਰੰਪਰਾਵਾਂ ਸਾਡੇ ਲਈ ਕਿਉਂ ਜ਼ਰੂਰੀ ਨੇ ਕਿਉਂ ਉਹਨਾਂ ਨੂੰ ਮਨਾਉਣਾ ਚਾਹੀਦਾ ਹੈ ਅਤੇ ਕਿਉਂ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ ਉਹ ਆਪਣੀਆਂ ਉਹ ਆਪਾਂ ਭਾਸ਼ਾ ਦੀ ਵਰਤੋਂ ਨਾਲ਼ ਆਪਣੀ ਪੀੜ੍ਹੀ ਨੂੰ ਸਿਖਾਉਂਦੇ ਹਾਂ ਅਤੇ ਆਪਣੀਆਂ ਪਰੰਪਰਾਵਾਂ ਦਾ ਇਤਿਹਾਸ ਦੱਸ ਕੇ ਆਪਣੀ ਪੀੜ੍ਹੀ ਨੂੰ ਉਹਨਾਂ ਪ ਪਰੰਪਰਾਵਾਂ ਨੂੰ ਸਨਮਾਨ ਦੇਣ ਲਈ ਰਾਜ਼ੀ ਕਰਦੇ ਹਾਂ ਅਤੇ ਇਹਦੇ ਲਈ ਭਾਸ਼ਾ ਦੀ ਵਰਤੋਂ ਪਰੰਪਰਾਵਾਂ ਨੂੰ ਸਨਮਾਨ ਅਤੇ ਮਨਾਉਣ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ ਅਤੇ ਆਪਾਂ ਉਹਨਾਂ ਦੇ ਭਾਸ਼ਾ ਦੀ ਵਰਤੋਂ ਰਾਹੀਂ ਹੀ ਆਪਣੀ ਜਿਹੜੀ ਨ ਦੂਜੀ ਪੀੜ੍ਹੀ ਹੁੰਦੀ ਹੈ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਜਿਹੜੀਆਂ ਪਰੰਪਰਾਵਾਂ ਨੇ ਅਸੀਂ ਕਿਉਂ ਮਨਾਉਂਦੇ ਹਾਂ ਅਤੇ ਕਿਉਂ ਤੁਹਾਨੂੰ ਵੀ ਮਨਾਉਣੀਆਂ ਚਾਹੀਦੀਆਂ ਨੇ ਅਤੇ ਅੱਗੇ ਆਪਣੀ ਪੀੜ੍ਹੀ ਨੂੰ ਵੀ ਦੱਸਣੀਆਂ ਚਾਹੀਦੀਆਂ ਨੇ